ਖੇਡਾਂ ਦੀ ਗੱਲ ਕਰੀਏ ਤਾਂ ਬੱਚੇ ਹੈ ਜਿਹੜੇ ਹਰ ਇੱਕ ਉਮਰ ਦੇ ਹਿਸਾਬ ਨਾਲ ਖੇਡਾਂ ਖੇਡਦੇ ਹੈ ਜਿਵੇਂ ਛੋਟੇ ਬੱਚੇ ਉਹ ਘਰ ਜਾਂ ਕਹਿ ਲਓ ਕਿ ਘਰ ਦੇ ਬਾਹਰ ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਆ ਟਰੈਕਟਰ ਹਰ ਇੱਕ ਸਮਾਜ ਦੇ ਅਨੁਸਾਰ ਜਿਵੇਂ ਪੇਂਡੂ ਬੱਚੇ ਇੱਕ ਟਰੈਕਟਰ ਵਗੈਰਾ ਨਾਲ ਖੇਡਦੇ ਹੈ ਸ਼ਹਿਰਾਂ ਵਾਲੇ ਬੱਚੇ ਉਹ ਪਜਲ਼ ਗੇਮਸ ਨਾਲ ਖੇਡਦੇ ਹੈ ਉਸ ਦੇ ਨਾਲ ਹੀ ਜਿਹੜੇ ਦਸ ਜਾਂ ਪੰਦਰਾਂ ਸਾਲ ਤੱਕ ਦੇ ਬੱਚੇ ਹੈ ਉਹ ਅਹ ਗੁੱਲੀ ਡੰਡਾ ਕੋਟਲਾ ਛਪਾਕੀ ਇਹ ਪੁਰਾਤਨ ਖੇਡਾਂ ਗਿੱਠ ਟੱਪਣਾ ਜਿਹੜੀਆਂ ਆਮ ਪਿੰਡਾਂ 'ਚ ਪ੍ਰਚਲਿਤ ਆ ਇਹ ਖੇਡਦੇ ਹੈ ਪਰ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਅੱਜ ਦੇ ਸਮੇਂ ਵਿੱਚ ਜੋ ਬੱਚੇ ਜਾਂ ਜੋ ਮਾਪੇ ਜਾਗਰੂਕ ਹੈ ਉਹ ਬੱਚਿਆਂ ਨੂੰ ਤੀਰ ਅੰਦਾਜ਼ੀ ਨਿਸ਼ਾਨੇਬਾਜ਼ੀ ਜਿਮਨਾਸਟਿਕ ਕ੍ਰਿਕਟ ਕਬੱਡੀ ਅਜਿਹੀਆਂ ਖੇਡਾਂ 'ਚ ਭੇਜਦੇ ਹੈ ਅਤੇ ਖਿਡਵਾਉਂਦੇ ਹੈ ਇਸ ਦੇ ਨਾਲ ਹੀ ਜੋ ਇੱਕ ਅੱਜ ਦੀ ਮੁੱਖ ਸਮੱਸਿਆ ਹੈ ਬੱਚਿਆਂ ਦਾ ਮੋਬਾਇਲ ਨਾਲ ਜੁੜਨਾ ਜੇ ਉਹ ਮੋਬਾਈਲ ਹੀ ਮੋਬਾਈਲ 'ਤੇ ਗੇਮਾਂ ਚੱਲਦੀਆਂ ਜਿਵੇਂ ਪਬਜੀ ਲੁਡੋ ਬੱਚਿਆਂ ਨੂੰ ਅੱਜ ਕੱਲ੍ਹ ਇਹਨਾਂ ਦੀ ਆਦਤ ਬਣਦੀ ਜਾ ਰਹੀ ਹੈ ਬੱਚੇ ਸਰੀਰਕ ਖੇਡਾਂ ਨਾ ਖੇਡ ਕੇ ਇਹ ਪਬਜੀ ਅਤੇ ਲੂਡੋ ਵਰਗੀਆਂ ਮੁਬਾਇਲੀ ਖੇਡਾਂ ਖੇਡਦੇ ਜਿਹਦੇ ਨਾਲ ਉਹ ਆਪਣਾ ਸਰੀਰ ਅਤੇ ਆਪਣਾ ਸਮਾਂ ਅਤੇ ਆਪਣੀ ਨਿਗਾਹ ਇਹ ਸਾਰਾ ਕੁਝ ਖ਼ਰਾਬ ਕਰ ਰਹੇ ਹੈਗੇ ਪਿੰਡਾਂ ਵਿੱਚ ਜਿਹੜਾ ਇਹ ਮਾਹੌਲ ਆ ਹਜੇ ਸੁਖਾਵਾਂ ਹੈ ਕਿਉਂਕਿ ਪਿੰਡਾਂ ਦੇ ਵਿੱਚ ਇੰਨਾ ਕਹਿ ਲਓ ਬੱਚਿਆਂ 'ਤੇ ਇਸ ਚੀਜ਼ ਦਾ ਪ੍ਰਭਾਵ ਨਹੀਂ ਜਿੰਨਾ ਸ਼ਹਿਰੀ ਬੱਚਿਆਂ 'ਤੇ ਪ੍ਰਭਾਵ ਹੈ